ਜੀ ਹਾਂ ਪੰਜਾਬੀ ਭਾਸ਼ਾ ਨਾਲ ਮੇਰਾ ਖਾਸ ਲਗਾਓ ਹੈ ਅਤੇ ਖੇਤਰੀ ਉਪਭਾਸ਼ਾਵਾਂ ਪੰਜਾਬੀ ਦੀ ਜਾਣਨੀ ਬੇਸ਼ਕ ਮੈਂ ਮਾਲਵੇ ਦੀ ਹਾਂ ਮਾਲਵੇ ਦੀ ਜਿਹੜੀ ਪੰਜਾਬੀ ਬੋਲੀ ਹੈ ਉਸ ਵਿੱਚ ਮੇਰੀ ਮੁਹਾਰਤ ਹਾਸਿਲ ਹੈ ਪਰ ਫਿਰ ਵੀ ਮੈਨੂੰ ਅੰਮ੍ਰਿਤਸਰ ਵੱਲ ਦੀ ਜਿਹੜੀ ਬੋਲੀ ਹੈ ਬੜੀ ਸੋਹਣੀ ਲੱਗਦੀ ਹੈ ਕੁਝ ਦੋਸਤ ਹਨ ਜੋ ਉਸ ਖੇਤਰ ਦੇ ਵਿੱਚ ਹਨ ਅਤੇ ਜਦੋਂ ਉਹ ਕਹਿਣ ਡਿਆ ਏ ਕਰਨ ਡਿਆ ਏ ਬੋਲਦੇ ਨੇ ਤਾਂ ਮੈਨੂੰ ਬੜਾ ਅੱਛਾ ਲੱਗਦਾ ਹੈ ਤਾਂ ਮੈਂ ਬਹੁਤ ਵਾਰ ਉਸ ਖੇਤਰ ਦੀ ਉਪ ਭਾਸ਼ਾ ਸਿੱਖੀ ਹੈ ਵਰਤੀ ਵੀ ਹੈ ਜਦੋਂ ਉਹਨਾਂ ਨਾਲ ਗੱਲਬਾਤ ਕਰਦੀ ਹਾਂ ਮੈਂ ਕਿਸੇ ਵੀ ਕਿਸਮ ਦਾ ਰਾਬਤਾ ਸਾਡਾ ਕਾਇਮ ਹੁੰਦਾ ਹੈ ਤਾਂ ਮੈਂ ਉਹਨਾਂ ਦੀ ਉਪਭਾਸ਼ਾ ਦਾ ਪ੍ਰਯੋਗ ਕਰਕੇ ਬੜੀ ਖੁਸ਼ੀ ਮਹਿਸੂਸ ਕਰਦੀ ਹਾਂ ਜਦੋਂ ਉਹ ਅੱਗੋਂ ਗੱਲ ਕਰਦੇ ਨੇ ਤਾਂ ਅਸੀਂ ਵੀ ਮਾਲਵੇ ਵਾਲੇ ਉਹਨਾਂ ਨੂੰ ਕਹਿੰਦੇ ਹਾਂ ਕਿ ਅਸੀਂ ਵੀ ਮਾਲਵੇ ਵਾਲੇ ਜਿਹੜੇ ਹੈ ਉਹ ਇਹ ਕਰਨ ਡਏ ਹਾਂ ਅਸੀਂ ਜੇ ਨਹੀਂ ਕਰਦੇ ਅਤੇ ਅਤੇ ਤੁਸਾਂ ਨੇ ਅਸਾਂ ਤੋਂ ਨਰਾਜ਼ ਹੋ ਜਾਣਾ ਹੈ ਅਤੇ ਇਸ ਤਰ੍ਹਾਂ ਜਿਹੜੀਆਂ ਦੂਜੀਆਂ ਉਪ ਭਾਸ਼ਾਵਾਂ ਨੇ ਉਹਨਾਂ ਨੂੰ ਮੈਂ ਸਿੱਖਦੀ ਵੀ ਹਾਂ ਵਰਤਦੀ ਵੀ ਹਾਂ ਸੋ ਮੈਨੂੰ ਬੇਹੱਦ ਪਿਆਰ ਹੈ ਪੰਜਾਬੀ ਦੀਆਂ ਉਪਭਾਸ਼ਾਵਾਂ ਨਾਲ ਆਪਣੀ ਮਾਂ ਬੋਲੀ ਪੰਜਾਬੀ ਨਾਲ ਅਤੇ ਇਹਨਾਂ ਉਪਭਾਸ਼ਾਵਾਂ ਨੂੰ ਵੱਖਰੇ ਵੱਖਰੇ ਸਮੇਂ 'ਤੇ ਮੈਂ ਸਟੱਡੀ ਵੀ ਕੀਤਾ ਹੈ ਇਹਨਾਂ ਨੂੰ ਮੈਂ ਪੜ੍ਹਨ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਸਿੱਖਣ ਦੀ ਵੀ ਅਤੇ ਖਾਸ ਤੌਰ 'ਤੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਅੰਮ੍ਰਿਤਸਰ ਵੱਲ ਦੀ ਜਿਹੜੀ ਉਪਭਾਸ਼ਾ ਹੈ ਉਹ ਮੈਨੂੰ ਵਧੇਰੀ ਚੰਗੀ ਲੱਗਦੀ ਹੈ